ਮੇਰਾ ਪੋਜ਼ੀਟਿਵ ਐਕਸਪੀਰੀਐਂਸ ਇਹ ਹੈ ਕਿ ਜਦੋਂ ਮੈਂ ਪਹਿਲਾਂ ਪ੍ਰੋਡਕਟ ਫਲਿੱਪਕਾਰਟ ਤੋਂ ਖਰੀਦਿਆ ਸੀ ਤਾਂ ਉਹ ਬਹੁਤ ਹੀ ਵਧੀਆ ਸੀ ਮੈਂ ਇੱਕ ਇੱਕ ਵਾਰੀ ਜੈਕਟ ਖਰੀਦੀ ਸੀ ਫਲਿੱਪਕਾਰਟ ਤੋਂ ਅਤੇ ਉਹ ਬਹੁਤ ਹੀ ਵਧੀਆ ਸੀ ਅਤੇ ਮੇਰਾ ਉਹ ਫੇਵਰਟ ਕਲਰ ਸੀ ਮੈਂ ਬਲੈਕ ਰੰਗ ਦਾ

ਫਲਿੱਪਕਾਰਟ ਵਾਲਿਆਂ ਨੇ ਕੈਸ਼ਬੈਕ ਵੀ ਦਿੱਤਾ ਤੇ ਤਾਂ ਜੋ ਮੈਨੂੰ ਕੋਈ ਪਰੇਸ਼ਾਨੀ ਨਾ ਆ ਸਕੇ ਅਤੇ ਉਹ ਮੇਰਾ ਫੇਵਰਟ ਕਲਰ ਸੀ ਅਤੇ ਜਦੋਂ ਮੈਂ ਯੂਨੀਵਰਸਿਟੀ ਜਾਂ ਸਕੂਲ ਵਿੱਚ ਪਾ ਕੇ ਜਾਂਦਾ ਸੀ ਤਾਂ ਉਹ ਬਹੁਤ ਹੀ ਨਿੱਘੀ ਸੀ ਇਸ ਲਈ ਸਰਦੀਆਂ ਵਿੱਚ ਉਹ ਬਹੁਤ ਹੀ ਕੰਮ ਆਉਂਦੀ ਸੀ ਅਤੇ ਮੈਨੂੰ ਨਾ ਕਿ ਠੰਡ ਵੀ ਨਹੀਂ ਲੱਗਦੀ ਸੀ ਇਸ ਲਈ ਠੰਡ ਵੀ ਨਹੀਂ ਲੱਗਦੀ ਸੀ ਅਤੇ ਉਹਨਾਂ ਨੇ ਮੈਨੂੰ ਬੜੇ ਹੀ ਘੱਟ ਤੋਂ ਘੱਟ ਪੜ੍ਹਾਈ ਪ੍ਰਾਈਸ ਵਿੱਚ ਦਿੱਤਾ ਅਤੇ ਉਸਦੇ ਉਸਨੂੰ ਧੋਣਾ ਵੀ ਬਹੁਤ ਕੰਫਰਟੇਬਲ ਹੈ ਨਾ ਉਹ ਬਹੁਤ ਹੀ ਭਾਰੀ ਹੈ ਨਾ ਉਹ ਜ਼ਿਆਦਾ ਹਲਕੀ ਇਸ ਲਈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਬਣੀ ਮੈਂ ਬਾਹਰੋਂ ਵੀ ਟਰਾਈ ਕੀਤਾ ਸੀ ਪਰ ਉਹਨਾਂ ਨੇ ਮੈਨੂੰ ਬਹੁਤ ਆਪਣੇ ਲਾਗੇ ਦੁਕਾਨ ਤੋਂ ਟਰਾਈ ਕੀਤਾ ਸੀ ਪਰ ਉਹ ਮੈਂ ਬਹੁਤ ਮਹਿੰਗੀ ਦੱਸ ਰਹੇ ਸਨ ਪਰ ਜਦੋਂ ਮੈਂ ਔਨਲਾਈਨ ਟਰਾਈ ਕੀਤਾ ਐਮਾਜੋਨ ਫਲਿੱਪਕਾਰਟ ਤੋਂ ਤਾਂ ਉਹਨਾਂ ਨੇ ਮੈਨੂੰ ਬਹੁਤ ਹੀ ਘੱਟ ਤੋਂ ਘੱਟ ਪ੍ਰਾਈਸ 'ਚ ਦਿੱਤੀ ਅਤੇ ਜਲਦੀ ਤੋਂ ਜਲਦੀ ਮੇਰੇ ਘਰ ਵਿੱਚ ਆ ਗਈ ਥੈਂਕ ਯੂ